ਮੋਹਾਲੀ ਜ਼ਿਲ੍ਹੇ ਦੇ ਵਿੱਚ ਸਿਹਤ ਦੇ ਸੰਬੰਧ ਵਿੱਚ ਕਾਫੀ ਸਾਰੇ ਹਸਪਤਾਲ ਨੇ ਉਹਨਾਂ ਵਿੱਚ ਕੁਝ ਪ੍ਰਾਈਵੇਟ ਵੀ ਨੇ ਕੁਝ ਸਰਕਾਰੀ ਵੀ ਨੇ ਕੁਝ ਛੋਟੇ ਵੀ ਨੇ ਅਤੇ ਕੁਝ ਵੱਡੇ ਵੀ ਨੇ ਹਰ ਇੱਕ ਵਰਗ ਨੂੰ ਮੁੱਖ ਰੱਖਦੇ ਹੋਏ ਸਰਕਾਰ ਵੱਲੋਂ ਜਾਂ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਵੱਲੋਂ ਇੱਥੇ ਸਿਹਤ ਸਹੂਲਤਾਂ ਦੇਣ ਦੇ ਲਈ ਜਿਹੜੇ ਹਸਪਤਾਲ ਨੇ ਜਾਂ ਕਮਿਊਨਟੀ ਸੈਂਟਰ ਨੇ ਉਹ ਬਣਾਏ ਗਏ ਨੇ ਤਾਂ ਜੋ ਲੋਕਾਂ ਨੂੰ ਸਿਹਤ ਦੇ ਪੱਖ ਤੋਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਨਾ ਆਵੇ ਇੱਥੇ ਬਹੁਤ ਸਾਰੇ ਅਮੀਰ ਲੋਕ ਵੀ ਨੇ ਜਾਂ ਮੁਲਾਜ਼ਮ ਲੋਕ ਵੀ ਨੇ ਜਾਂ ਰਾਜਨੀਤਿਕ ਆਗੂ ਵੀ ਨੇ ਜਿਹੜੇ ਕਿ ਵੱਡੇ ਆਪਣੇ ਅਸਰ ਰਸੂਖ ਰੱਖ ਰਹੇ ਨੇ ਪਰ ਉਹ ਆਪਣਾ ਜਿਹੜਾ ਇਲਾਜ ਹੈ ਉਹ ਮਹਿੰਗੇ ਹਸਪਤਾਲਾਂ ਵਿੱਚ ਕਰਾਉਂਦੇ ਨੇ ਜਿਹੜੇ ਆਮ ਗਰੀਬ ਵਰਗ ਹੈ ਉਹਨਾਂ ਲਈ ਸਰਕਾਰੀ ਡਿਸਪੈਂਸਰੀਆਂ ਨੇ ਸਰਕਾਰੀ ਛੋਟੇ ਜਿਹੜੇ ਹੈਗੇ ਨੇ ਸੁਵਿਧਾ ਕੇਂਦਰ ਸਿਹਤ ਕੇਂਦਰ ਨੇ ਉਹਨਾਂ ਵਿੱਚ ਲੋਕ ਆਪਣੇ ਇਲਾਜ ਕਰਵਾ ਰਹੇ ਨੇ ਅਤੇ ਜਿਹੜੀ ਗੱਲ ਰਹੀ ਕੋਵਿਡ ਦੀ ਕੋਵਿਡ ਦੇ ਵਿੱਚ ਹਰ ਛੋਟੇ ਤੋਂ ਛੋਟੇ ਅਤੇ ਵੱਡੇ ਤੋਂ ਵੱਡੇ ਹਸਪਤਾਲ ਨੇ ਆਪਣੀ ਜਿਹੜੀ ਸੇਵਾ ਉਹ ਨਿਭਾਈ ਹੈ ਔਰ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਹੈ